ਮੈਂ ਸਮਾਜ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਸਾਨੂੰ ਨਸ਼ੇ ਨਹੀਂ ਕਰਨੇ ਚਾਹੀਦੇ ਜੋ ਕਿ ਸਾਡੀ ਸਿਹਤ ਲਈ ਬਹੁਤ ਹਾਨੀਕਾਰਕ ਹਨ ਇਹਨਾਂ ਦੇ ਸਾਈਡ ਇਫੈਕਟ ਜੋ ਕਿ ਤੁਹਾਨੂੰ ਪਤਾ ਹੀ ਹੈ ਖਾਂਸੀ ਤੇਅ ਛਾਤੀ ਦਾ ਜਾਮ ਹੋਣਾ ਜਾਂ ਕੈਂਸਰ ਜਿਹੀ ਬਮ ਗੰਭੀਰ ਬਿਮਾਰੀ ਹੋਣਾ ਜੋ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਸਾਡੀ ਨਸ਼ੇ ਕਰਨ ਨਾਲ ਬਹੁਤ ਹੀ ਸਿਹਤ ਡਾਊਨ ਚਲ ਜਾਂਦੀ ਹੈ ਸਾਨੂੰ ਕਦੀ ਵੀ ਨਸ਼ੇ ਨਹੀਂ ਕਰਨੇ ਚਾਹੀਦੇ ਮੈਂ ਸਾਰਿਆਂ ਨੂੰ ਇਹੀ ਗੱਲ ਕਹਾਂਗਾ